ਪੰਜਾਬ ਦਾ ਜਿਹੜਾ ਖੇਤੀਬਾੜੀ ਉਹ ਮੁੱਖ ਧੰਦਾ ਹੈ ਅਤੇ ਸਾਨੂੰ ਸਭ ਨੂੰ ਪਤਾ ਆ ਜਿਵੇਂ ਕਿ ਖੇਤੀਬਾੜੀ ਜੋ ਧੰਦਾ ਹੈ ਉਹ ਮੌਸਮ ਦੀਆਂ ਸਥਿਤੀਆਂ ਦੇ ਉੱਤੇ ਨਿਰਭਰ ਕਰਦਾ ਹੈ ਜੇ ਲੋੜ ਅਨੁਸਾਰ ਬਾਰਿਸ਼ ਹੁੰਦੀ ਰਹੇ ਤਾਂ ਜਿਹੜੀਆਂ ਫਸਲਾਂ ਨੇ ਬੜੀਆਂ ਵਧੀਆ ਅਤੇ ਚੰਗਾ ਫਲ ਲੈ ਕੇ ਆਉਂਦੀਆਂ ਨੇ ਜੋ ਕਿ ਕਿਸਾਨਾਂ ਦੇ ਲਈ ਬਹੁਤ ਲਾਹੇਵੰਦ ਸਾਬਤ ਹੁੰਦੀਆਂ ਨੇ ਪਰ ਮੋਸਲ ਮੌਸਮ ਦੇ ਉੱਤੇ ਨਿਰਭਰ ਹੋਣ ਦੇ ਕਾਰਨ ਜੇਕਰ ਗੜ੍ਹੇਮਾਰੀ ਹੁੰਦੀ ਹੈ ਕੋਈ ਤੂਫਾਨ ਆਉਂਦੇ ਹਨ ਤਾਂ ਉਹਨਾਂ ਦੇ ਨਾਲ ਜਿਹੜੀਆਂ ਫਸਲਾਂ ਨੇ ਉਹ ਬਰਬਾਦ ਵੀ ਹੋ ਜਾਂਦੀਆਂ ਨੇ ਜਿਵੇਂ ਸਾਡੇ ਪੰਜਾਬ ਦੀਆਂ ਮੁੱਖ ਫਸਲਾਂ ਜਿਵੇਂ ਨਰਮਾ ਹੋਇਆ ਕਪਾਹ ਹੋਈ ਜਿਵੇਂ ਕਣਕ ਹੋਈ ਇਹ ਸਾਰੀਆਂ ਜਿਹੜੀਆਂ ਫਸਲਾਂ ਨੇ ਇਹ ਜਦੋਂ ਮੀਂਹ ਜ਼ਿਆਦਾ ਆਉਂਦਾ ਹੈ ਜਾਂ ਗੜ੍ਹੇਮਾਰੀ ਹੁੰਦੀ ਹੈ ਤਾਂ ਜਿਹੜਾ ਫਸਲਾਂ ਦਾ ਬਹੁਤ ਜ਼ਿਆਦਾ ਜਿਹੜਾ ਖਾਮਿਆਜ਼ਾ ਜਿਹੜਾ ਆ ਫਸਲਾਂ ਦਾ ਉਹ ਕਿਸਾਨਾਂ ਨੂੰ ਭੁਗਤਣਾ ਪੈਂਦਾ ਹੈ ਤਾਂ ਹੁਣ ਅਸੀਂ ਦੇਖਿਆ ਜਾਵੇ ਜੇਕਰ ਸਾਡੀਆਂ ਫਸਲਾਂ ਤਬਾਹ ਹੋ ਜਾਂਦੀਆਂ ਨੇ ਕਿਸਾਨ ਕੋਲ ਹੋਰ ਕੋਈ ਹੱਲ ਨਹੀਂ ਹੁੰਦਾ ਤਾਂ ਉਸ ਕੋਲ ਇੱਕ ਕਮਾਈ ਦਾ ਦੂਜਾ ਸਾਧਨ ਹੋਣਾ ਇੱਕ ਬਹੁਤ ਜ਼ਰੂਰੀ ਆ ਤਾਂ ਜੇ ਅਸੀਂ ਫਰਜ਼ ਕਰੀਏ ਕਿ ਜੇਕਰ ਫਸਲਾਂ ਜਿਹੜੀਆਂ ਉਹ ਖਤਮ ਹੋ ਜਾਂਦੀਆਂ ਨੇ ਬਰਬਾਦ ਹੋ ਜਾਂਦੀਆਂ ਨੇ ਤਾਂ ਕਿਸਾਨਾਂ ਦੇ ਕੋਲ ਇੱਕ ਦੂਜਾ ਇੱਕ ਸਾਧਨ ਹੋਣਾ ਚਾਹੀਦਾ ਹੈ ਜਿਸ ਦੇ ਨਾਲ ਉਹ ਆਪਣੇ ਆਰਥਿਕ ਸਥਿਤੀ ਨੂੰ ਡਾਵਾਂਡੋਲ ਹੋਣ ਤੋਂ ਬਚਾ ਸਕੇ ਤਾਂ ਮੈਂ ਤਾਂ ਅ ਅਸੀਂ ਸਾਡੇ ਜਿਹੜੇ ਖਿਆਲ ਨੇ ਇਹੀ ਦੱਸਦੇ ਨੇ ਜਿਵੇਂ ਕਿਸਾਨੀ ਪੱਧਰ ਦੇ ਵਿੱਚ ਦੇਖਿਆ ਜਾਵੇ ਤਾਂ ਪਸ਼ੂ ਪਾਲਣ ਹੈ ਜਿਹੜਾ ਇੱਕ ਬਹੁਤ ਵਧੀਆ ਕਿੱਤਾ ਹੈ ਜਾਂ ਮੱਛੀ ਫਾਰਮਿੰਗ ਸਭ ਤੋਂ ਵਧੀਆ ਕਿੱਤਾ ਹੈ ਜਿਸ ਦੇ ਵਿੱਚ ਜ਼ਿਆਦਾ ਮੌਸਮ ਦਾ ਪ੍ਰਭਾਵ ਪੈਣ ਕਰਕੇ ਜਿਹੜਾ ਉਹਨਾਂ ਦੀ ਫਸਲ ਆ ਜਿਹੜੀ ਉਹ ਬਰਬਾਦ ਨਹੀਂ ਹੋਵੇਗੀ ਤਾਂ ਅਜਿਹੇ ਹੀ ਜਿਹੜੇ ਕੰਮ ਨੇ ਸਾਡੇ ਕਿਸਾਨਾਂ ਨੂੰ ਸਾਡੇ ਪੰਜਾਬ ਦੇ ਕਿਸਾਨਾਂ ਨੂੰ ਜਿਹੜੇ ਕਰਨੇ ਚਾਹੀਦੇ ਨੇ ਕਿ ਤਾਂ ਕਿ ਜਿਹੜੇ ਬਦਲਦੇ ਮੌਸਮਾਂ ਦੇ ਕਾਰਨ ਜਿਹੜੀਆਂ ਫਸਲਾਂ ਤਬਾਹ ਹੁੰਦੀਆਂ ਨੇ ਉਹਨਾਂ ਦਾ ਬਹੁਤਾ ਅਸਰ ਸਾਡੇ ਆਰਥਿਕ ਜੀਵਨ ਦੇ ਉੱਤੇ ਨਾ ਪਵੇ